ਹੈਲੋ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਕਦੇ ਵੀ ਔਨਲਾਈਨ ਸ਼ੌਪਿੰਗ ਕਦੇ ਨਹੀਂ ਕਰਦੀ ਹੁੰਦੀ ਸੀ ਪਹਿਲੀ ਵਾਰ ਮੈਂ ਔਨਲਾਈਨ ਆਪਣੇ ਲੀਏ ਜੁੱਤੇ ਮੰਗਵਾਏ ਪਹਿਲੀ ਵਾਰ ਐਮਾਜ਼ੋਨ ਤੋਂ ਮੈਂ ਜੁੱਤੇ ਮੰਗਵਾਏ ਅਤੇ ਜਿੱਦਾਂ ਮੈਨੂੰ ਪਿੱਚਰ 'ਚ ਦਿਖਾਏ ਗਏ ਸੀ ਬਿਲਕੁਲ ਉੱਦਾਂ ਹੀ ਮੇਰੇ ਜੁੱਤੇ ਆਏ ਲੋਕਾਂ ਦੇ ਜੁੱਤੇ ਕਈ ਲੋਕ ਮੰਗਵਾਉਂਦੇ ਹੁੰਦੇ ਆ ਮੀਸ਼ੋ ਤੋਂ ਕਿਤੋਂ ਕਿਤੋਂ ਫਟੇ ਹੋਏ ਆ ਜਾਂਦੇ ਆ ਕਿਤੋਂ ਉਹ ਉੱਧੜੇ ਹੋਏ ਆ ਜਾਂਦੇ ਆ ਕਈ ਵਾਰ ਰੰਗ ਬੇਕਾਰ ਹੋ ਜਾਂਦਾ ਹੈ ਮੈਨੂੰ ਆਹੀ ਅੰਦਰੋਂ ਡਰ ਸੀ ਕਿ ਮੇਅ ਬੀ ਮੇਰੇ ਰੰਗ ਸ਼ੂਜ ਦਾ ਬੇਕਾਰ ਆਵੇ ਜਾਂ ਖਰਾਬ ਆਵੇ ਕਿੱਥੇ ਮੇਰੇ ਪੈਸੇ ਬਰਬਾਦ ਨਾ ਹੋ ਜਾਏ ਮੈਨੂੰ ਇਹ ਅੰਦਰੋਂ ਡਰ ਸੀਗਾ ਲੇਕਿਨ ਜਦੋਂ ਮੇਰੇ ਸ਼ੂਜ਼ ਦਾ ਜੁੱਤਾਂ ਦਾ ਡੱਬਾ ਆਇਆ ਮੈਨੂੰ ਜਦੋਂ ਮੈਂ ਖੋਲ੍ਹਿਆ ਤਾਂ ਮੈਂ ਦੇਖਿਆ ਜਿੱਦਾਂ ਦੇ ਮੈਂ ਪਿੱਚਰ 'ਚ ਦੇਖੇ ਸੀ ਬਿਲਕੁਲ ਉੱਦਾਂ ਹੈ ਅਤੇ ਦੂਜੀ ਗੱਲ ਇੱਕ ਦਮ ਸਮੇਂ 'ਤੇ ਆਏ ਮੈਨੂੰ ਇਹ ਡਰ ਸੀਗਾ ਕਿ ਮੇਅ ਬੀ ਇਹ ਸਮੇਂ 'ਤੇ ਨਹੀਂ ਆਓਗੇ ਚਾਰ ਦਿਨ ਪੰਜ ਦਿਨ ਛੇ ਦਿਨ ਕਿੰਨੇ ਦਿਨ ਹੋ ਜਾਓਗੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਤਿੰਨ ਦਿਨ 'ਚ ਡਿਲੀਵਰ ਕਰ ਦਾਂਗੇ ਅਤੇ ਤਿੰਨ ਦਿਨ 'ਚ ਹੀ ਮੈਨੂੰ ਡਿਲੀਵਰ ਹੋ ਕੇ ਮਿਲ ਵੀ ਗਏ ਅਤੇ ਬਹੁਤ ਹੀ ਵਧੀਆ ਹੈਗੇ ਆ ਮੈਂ ਪਾ ਕੇ ਦੇਖੇ ਸਾਈਜ਼ ਇਕਦਮ ਸਹੀ ਹੈਗਾ ਕੰਫਰਟੇਬਲ ਹੈਗੇ ਆ ਨਾ ਹੀ ਕੋਈ ਇਹ 'ਚ ਖਰਾਬੀ ਹੈਗੀ ਆ ਮੈਂ ਦੂਜੇ ਲੋਕਾਂ ਨੂੰ ਵੀ ਆਹੀ ਕਹਾਂਗੀ ਕਿ ਇੱਥੋਂ ਹੀ ਸਮਾਨ ਖਰੀਦਣਾ ਚਾਹੀਦਾ ਹੈ ਇੱਥੇ ਬਹੁਤ ਵਧੀਆ ਸਮਾਨ ਮਿਲਦਾ ਹੈਗਾ ਆ ਧੰਨਵਾਦ